ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਭ ਤੋਂ ਬੜੀ ਚੀਜ਼ ਹੈ ਦੇਖਣ ਵਾਸਤੇ ਇੱਕ ਧਾਰਮਿਕ ਸਥਾਨ ਵੀ ਹੈ ਅਤੇ ਦੂਸਰਾ ਜੋ ਉਹ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਅਦੁੱਤੀ ਚੀਜ਼ ਹੈ ਜੋ ਉਹਦਾ ਕੋਈ ਨਾ ਤਾਂ ਕੋਈ ਨੇੜੇ ਤੇੜੇ ਕੋਈ ਉਹਦਾ ਮੇਲ ਜੋਲ ਹੈ ਅਤੇ ਨਾ ਕਦੀ ਹੋਣਾ ਹੈ ਅਤੇ ਅੰਮ੍ਰਿਤਸਰ ਦੇ ਵਿੱਚ ਹੀ ਬਾਘਾ ਬਾਰਡਰ ਹੈ ਜੋ ਕਿ ਪਾਕਿਸਤਾਨ ਨਾਲ ਲੱਗਦਾ ਆਪਣਾ ਬੋਰਡਰ ਹੈ ਉੱਥੇ ਸ਼ਾਮ ਨੂੰ ਰੀਟ੍ਰੀਟ ਸੈਰੇਮਨੀ ਜਿਹੜੀ ਹੁੰਦੀ ਉਹ ਦੇਖਣ ਵਾਲੀ ਹੁੰਦੀ ਹੈ ਤੁਹਾਡਾ ਕਪੂਰਥਲਾ ਦੇ ਵਿੱਚ ਫਿਲਮ ਸੀ ਸਾਇੰਸ ਸਿਟੀ ਹੈ ਔਰ ਆਨੰਦਪੁਰ ਸਾਹਿਬ ਦੇ ਵਿੱਚ ਆ ਜਾਈਏ ਜਿੱਥੇ ਖ਼ਾਲਸਾ ਪੰਥ ਦੀ ਸਾਜਨਾ ਹੋਈ ਸੀ ਗੁਰਦੁਆਰਾ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਅਤੇ ਨਾਲ ਵਿਰਾਸਤ ਏ ਖਾਲਸਾ ਅਤੇ ਚਮਕੌਰ ਸਾਹਿਬ ਦੇ ਵਿੱਚ ਜਿੱਥੇ ਬੜੇ ਸਾਹਿਬਜ਼ਾਦੇ ਸ਼ਹੀਦ ਹੋਏ ਸੀਗੇ ਉੱਥੇ ਅ ਦਾਸਤਾਨ ਏ ਸ਼ਹਾਦਤ ਇੱਕ ਮਿਊਜ਼ੀਅਮ ਬਣਿਆ ਹੋਇਆ ਬਹੁਤ ਵਧੀਆ ਦੇਖਣ ਵਾਲਾ ਹੈ ਤਾਂ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਕਾਫੀ ਸਾਰੇ ਏਰੀਅਸ ਹੈਗੇ ਦੇਖਣ ਲਈ